ਖੇਡਾਂ ਬੱਚਿਆਂ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ ਪਹਿਲਾਂ ਬੱਚੇ ਬਹੁਤ ਸਾਰੇ ਖੇਡ ਖੇਡਦੇ ਸਨ ਜਿਵੇਂ ਕਬੱਡੀ ਕ੍ਰਿਕਟ ਖੋ ਖੋ ਬਹੁਤ ਸਾਰੇ ਬਾਹਰੀ ਗੇਮ ਬੱਚੇ ਖੇਡਦੇ ਸਨ ਅੱਜ ਕੱਲ੍ਹ ਬੱਚੇ ਮੋਬਾਈਲਾਂ 'ਚ ਬੀਜੀ ਹੋ ਗਏ ਹਨ ਬਾਹਰ ਦੀਆਂ ਜੋ ਖੇਡਾਂ ਹੈ ਉਹ ਬੱਚਿਆਂ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ ਕਿਉਂਕਿ ਉਹਨਾਂ ਦਾ ਮਾਇੰਡ ਹੈ ਜੋ ਵਿਕਸਿਤ ਹੁੰਦਾ ਹੈ ਖੇਡਾਂ ਨਾਲ ਹੀ ਇਸ ਤਰ੍ਹਾਂ ਮਾਰਸ਼ਲ ਆਰਟ ਵੀ ਬਹੁਤ ਜ਼ਰੂਰੀ ਇੱਕ ਖੇਡ ਹੈ ਜੋ ਕਿ ਜੋ ਕਿ ਕਾਫ਼ੀ ਸਾਲਾਂ 'ਚ ਬਹੁਤ ਹੀ ਵਿਕਸਿਤ ਹੁੰਦਾ ਜਾ ਰਿਹਾ ਹੈ ਮਾਰਸ਼ਲ ਆਰਟ ਨਾਲ ਬੱਚਿਆਂ ਦੀ ਐਕਸਰਸਾਈਜ਼ ਵੀ ਹੋ ਜਾਂਦੀ ਹੈ ਅਤੇ ਉਹਨਾਂ ਦੇ ਸਰੀਰ ਦਾ ਵੀ ਬਹੁਤ ਵਿਕਾਸ ਹੁੰਦਾ ਹੈ ਮਾਰਸ਼ਲ ਆਰਟ ਜੋ ਹੈ ਇਸਨੂੰ ਪ੍ਰਸਿੱਧ ਬਣਾਉਣ ਲਈ ਸਾਨੂੰ ਬਹੁਤ ਸਾਰੇ ਇਸ ਵਿੱਚ ਸੁਧਾਰ ਦੀ ਲੋੜ ਹੈ ਸਾਨੂੰ ਇਸਦੀਆਂ ਬਹੁਤ ਸਾਰੀਆਂ ਅਕੈਡਮੀਆਂ ਅਕੈਡਮੀਆਂ ਬਣਾਉਣੀਆਂ ਚਾਹੀਦੀਆਂ ਹਨ ਜਿਸ ਵਿੱਚ ਬੱਚੇ ਸਮੇਂ ਸਮੇਂ 'ਤੇ ਜਾ ਕੇ ਇਸ ਦੀ ਪ੍ਰੈਕਟਿਸ ਕਰਨ ਅਤੇ ਇਸ ਇਸ ਗੇਮਸ ਨੂੰ ਅੱਗੇ ਲੈ ਕੇ ਜਾਣ ਸਰਕਾਰ ਤਰਫੋਂ ਵੀ ਇਹ ਇਹਨਾਂ ਗੇ ਖੇਡਾਂ ਲਈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਜਦੋਂ ਇਹ ਇਸ ਖੇਡਾਂ ਵਿੱਚ ਬੱਚੇ ਖੇਡ ਰਹੇ ਹੈ ਤਾਂ ਉਹਨਾਂ ਨੂੰ ਫਾਸਟ ਫੂਡ ਜੋ ਹੈ ਉਹ ਨਹੀਂ ਖਾਣਾ ਚਾਹੀਦਾ ਹੈ ਉਹਨਾਂ ਨੂੰ ਘਰ ਦਾ ਖਾਣਾ ਹੀ ਖਾਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਸਰੀਰ ਮਜ਼ਬੂਤ ਬਣੇ ਅਤੇ ਉਹ ਗੇਮਸ ਨੂੰ ਖੇਡਾਂ ਨੂੰ ਬਹੁਤ ਚੰਗੀ ਤਰ੍ਹਾਂ ਖੇਡ ਸਕਣ ਅਤੇ ਇਸ ਤਰ੍ਹਾਂ ਸਾਨੂੰ ਇਹਨਾਂ ਮਾਰਸ਼ਲ ਆਰਟ ਦੀਆਂ ਬਹੁਤ ਸਾਰੀਆਂ ਅਕੈਡਮੀਆਂ ਬਣਾ ਕੇ ਬੱਚਿਆਂ ਨੂੰ ਇਸ ਖੇਡਾਂ ਵੰਨੀ ਪ੍ਰੋਤਸਾਹਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਗੇਮਸ ਖੇਡ ਕੇ ਆਪਣਾ ਮਾਇੰਡ ਆਪਣੇ ਦਿਮਾਗ ਦਾ ਬਹੁਤ ਵਿਕਾਸ ਕਰ ਸਕਣ